ਜੇਕਰ ਡਾਂਸ ਕਰਨ ਨਾਲ ਲੋਕ ਖੁਸ਼ੀ ਮਹਿਸੂਸ ਕਰਦੇ ਹਨ ਤਾਂ ਡਾਂਸ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ ਡਾਂਸ ਕਰਦੇ ਸਮੇਂ ਲੋਕ ਖੁਸ਼ੀ ਮਹਿਸੂਸ ਕਰਦੇ ਹਨ ਕਿਉਂਕਿ ਉਹ ਸਭ ਟੈਨਸ਼ਨਾਂ ਪਰੇਸ਼ਾਨੀਆਂ ਭੁੱਲ ਕੇ ਜਦੋਂ ਕੋਈ ਵਿਅਕਤੀ ਖੁਦ ਨਾਲ ਆਪਣਾ ਸਮਾਂ ਬਤੀਤ ਕਰਦਾ ਹੈ ਤਾਂ ਉਹ ਜਾਂ ਤਾਂ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ ਕੋਈ ਵਿਅਕਤੀ ਜਿੰਨਾ ਜ਼ਿਆਦਾ ਖੁਸ਼ ਹੁੰਦਾ ਹੈ ਓਨਾਂ ਜ਼ਿਆਦਾ ਖੁੱਲ੍ਹ ਕੇ ਡਾਂਸ ਕਰਦਾ ਹੈ ਆਪਣੇ ਦਿਲ ਤੋਂ ਡਾਂਸ ਕਰਦਾ ਹੈ ਡਾਂਸ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਡਾਂਸ ਕਰਦਾ ਡਾਂਸ ਕਰਦਾ ਹੈ ਤਾਂ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿੰਦਾ ਹੈ ਸਰੀਰਕ ਤੌਰ 'ਤੇ ਇਸ ਤਰ੍ਹਾਂ ਕਿ ਉਹ ਹਿਲਜੁਲ ਕਰਦਾ ਰਹਿੰਦਾ ਹੈ ਆਪਣੇ ਹੱਥ ਪੈਰ ਖੋਲ੍ਹ ਕੇ ਨੱਚ ਸਕਦਾ ਹੈ ਵੱਧ ਤੋਂ ਵੱਧ ਸਮਾਂ ਆਪਣੇ ਖੁਦ ਨਾਲ ਬਤੀਤ ਕਰਦਾ ਹੈ ਜਿਸ ਨਾਲ ਕਿ ਉਹ ਸਰੀਰਕ ਤੌਰ 'ਤੇ ਫਿਟ ਰਹਿੰਦਾ ਹੈ ਮਾਨਸਿਕ ਤੌਰ 'ਤੇ ਹੈ ਕਿ ਉਹ ਸਭ ਪਰੇਸ਼ਾਨੀਆਂ ਭੁੱਲ ਜਾਂਦਾ ਹੈ ਖੁੱਲ੍ਹ ਕੇ ਡਾਂਸ ਕਰ ਸਕਦਾ ਹੈ ਇਕੱਲਤਾ ਪਣ ਨੂੰ ਦੂਰ ਕਰਦਾ ਹੈ ਡਾਂਸ ਡਾਂਸ ਨੂੰ ਇੱਕ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਹੈ ਜੋ ਕਿ ਮਾਨਸਿਕ ਅਤੇ ਸਰੀਰਕ ਦੋਨਾਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ ਹਰ ਵਿਅਕਤੀ ਵਿੱਚ ਇੱਕ ਨਾ ਇੱਕ ਡਾਂਸਰ ਜ਼ਰੂਰ ਛੁਪਿਆ ਹੁੰਦਾ ਹੈ ਸੋ ਭਾਰਤ ਵਿੱਚ ਡਾਂਸ ਨੂੰ ਮੰਨੋਰੰਜਨ ਦਾ ਸਾਧਨ ਵੀ ਮੰਨਿਆ ਜਾਂਦਾ ਹੈ